ਜੀ ਮੈਂ ਔਟੋਮੈਟਿਕ ਅਨੁਵਾਦ ਜਾਂ ਗੂਗਲ ਸਪੇਸ ਦੀ ਵਰਤੋਂ ਕੀਤੀ ਹੈ ਉਹ ਕਈ ਵਾਰ ਤਾਂ ਸਹੀ ਰਹਿੰਦੇ ਹਨ ਪਰ ਕਈ ਵਾਰ ਉਹ ਗਲਤ ਵੀ ਦੱਸ ਦਿੰਦੇ ਹਨ ਇੱਕ ਵਾਰੀ ਹੋਇਆ ਸੀ ਕਿ ਮੈਂ ਅੱਧੀ ਰਾਤ ਘਰ ਵਾਪਸ ਆ ਰਹੀ ਸੀ ਮੈਂ ਕਿਸੇ ਦੂਸਰੇ ਸ਼ਹਿਰ 'ਚ ਗਈ ਸੀ ਉੱਥੇ ਮੈਂ ਆਪਣਾ ਰਾਹ ਭੁੱਲ ਗਈ ਸੀ ਮੈਂ ਗੂਗਲ ਮੈਪਸ ਦੀ ਵਰਤੋਂ ਨਾਲ ਘਰ ਤਾਂ ਵਾਪਸ ਆ ਗਈ ਪਰ ਉਹਨੇ ਮੈਨੂੰ ਕਾਫ਼ੀ ਲੰਬਾ ਰਸਤਾ ਗਲੀਆਂ ਗਲੀਆਂ ਵਿੱਚੋਂ ਦੱਸਿਆ ਜਿਸ ਨਾਲ ਮੇਰਾ ਕਾਫ਼ੀ ਸਮਾਂ ਕਾਫ਼ੀ ਜ਼ਿਆਦਾ ਸਮਾਂ ਵੇਸਟ ਹੋ ਗਿਆ ਭਾਵੇਂ ਉਹਨੇ ਮੈਨੂੰ ਸਹੀ ਰਾਹ ਦੱਸਿਆ ਮੈਂ ਕਾਫ਼ੀ ਉਹਦੀ ਵਰਤੋਂ ਨਾਲ ਖੁਸ਼ ਸੀ ਕਿਉਂਕਿ ਉਹ ਕ ਰਾਤ ਵੀ ਕਾਫ਼ੀ ਹੋ ਗਈ ਸੀ ਅਤੇ ਮੈਂ ਇਕੱਲੀ ਸੀ ਪਰ ਇੱਕ ਵਾਰੀ ਕੀ ਹੋਇਆ ਮੈਂ ਆਪਣੇ ਪੂਰੇ ਪਰਿਵਾਰ ਨਾਲ ਕਿਸੇ ਦੂਜੇ ਸ਼ਹਿਰ ਵਿੱਚ ਗਈ ਸੀ ਅਸੀਂ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਜਾਣਾ ਸੀਗਾ ਅਤੇ ਸਾਨੂੰ ਰਾਹ ਨਹੀਂ ਸੀ ਮਿਲ ਰਿਹਾ ਅਸੀਂ ਗੂਗਲ ਮੈਪਸ ਦੀ ਵਰਤੋਂ ਨਾਲ ਸਾਰਾ ਐਡਰੈਸ ਪਾਇਆ ਅਤੇ ਅਸੀਂ ਘੰਟਾ ਲਾ ਕੇ ਉਸ ਐਡਰੈਸ ਤੱਕ ਪਹੁੰਚੇ ਪਰ ਉਹ ਐਡਰੈਸ ਬਿਲਕੁਲ ਹੀ ਗਲਤ ਸੀ ਫਿਰ ਅਸੀਂ ਗੂਗਲ ਮੈਪਸ ਬੰਦ ਕੀਤਾ ਅਤੇ ਲੋਕਾਂ ਦੀ ਮਦਦ ਨਾਲ ਪੁੱਛ ਪੁੱਛ ਕੇ ਆਪਣੇ ਰਿਸ਼ਤੇਦਾਰਾਂ ਦੇ ਘਰ ਪਹੁੰਚੇ ਗੂਗਲ ਮੈਪਸ ਕਈ ਵਾਰ ਤਾਂ ਸਹੀ ਰਹਿੰਦਾ ਹੈ ਪਰ ਕਈ ਵਾਰ ਕਾਫ਼ੀ ਨੁਕਸਾਨ ਵੀ ਕਰ ਦਿੰਦਾ ਹੈ